ਅਗਲੇ ਕੁਝ ਸਾਲਾਂ ਵਿੱਚ ਤਕਨੀਕੀ ਰੁਝਾਨਾਂ ਅਤੇ ਨਵੀਆਂ ਟੈਕਨੋਲਜੀਆਂ ਦਾ ਪ੍ਰਭਾਵ ਇੰਨਾ ਕੁ ਹੋ ਸਕਦਾ ਹੈ ਕਿ ਇਹ ਸਾਡੀ ਲੋੜਵੰਦ ਅਤੇ ਰੋਜ਼ਮਰਾ ਦੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਮੇਰਾ ਪਹਿਲਾ ਸੁਝਾਅ ਹੈ ਏ ਆਈ ਜਿਹਦੇ ਵਿੱਚ ਵਿਦਿਆਰਥੀ ਨਵੀਂ ਨਵੀਂ ਟੈਕਨੋਲਜੀਆਂ ਪੇਸ਼ ਕਰ ਰਹੇ ਹਨ ਜੀਵਨ ਦੇ ਹਰ ਖੇਤਰ ਵਿੱਚ ਏ ਆਈ ਇੱਕ ਇਹ ਜਿਹੀ ਚੀਜ਼ ਹੈ ਜਿਹਦੇ ਵਿੱਚ ਇਸ ਨਾਲ ਇਸ ਦਾ ਪੋਜਿਟਿਵ ਚੀਜ਼ਾਂ ਵੀ ਹੋ ਸਕਦੀਆਂ ਹੈ ਹਨ ਦੂਜਾ ਹੈ ਵੀ ਆਰ ਅਤੇ ਏ ਆਰ ਇਹ ਤਕਨੀਕੀ ਨਾਲ ਸਿੱਖਣਾ ਕੰਮ ਕਰਨਾ ਅਤੇ ਮਨੋਰੰਜਨ ਦਾ ਤਰੀਕਾ ਕਾਫ਼ੀ ਬਦਲ ਸਕਦਾ ਹੈ ਜਿਵੇਂ ਕਿ ਗੇਮਿੰਗ ਫ਼ਿਲਮਾਂ ਅਤੇ ਪ੍ਰੋਫੈਸ਼ਨਲ ਡਿਜ਼ਾਈਨ ਹੋਰ ਆਪਣੀ ਨਿੱਜੀ ਜੀਵਨ ਵਿੱਚ ਇਹ ਸਾਰੀਆਂ ਤਕਨੀਕਾਂ ਅਤੇ ਰੁਝਾਨ ਅਨੁਭਾਵਾਂ ਨੂੰ ਬਦਲਣ ਦੇ ਨਾਲ ਨਾਲ ਮਨੋਰੰਜਨ ਅਤੇ ਕੰਮ ਦੇ ਤਰੀਕਿਆ ਨੂੰ ਵੀ ਦਿਸ਼ਾ ਦੇ ਸਕਦੇ ਹਨ ਸਿਹਤ ਅਤੇ ਫਿੱਟਨੈੱਸ ਦਾ ਵੀ ਇੱਕ ਅਜਿਹਾ ਰੋਲ ਡਿਜੀਟਲ ਡਿਵਾਈਸ ਪੂਰਾ ਕਰ ਰਹੀ ਹੈ ਜਿਸ ਵਿੱਚ ਆਪਾਂ ਫਿੱਟਨੈੱਸ ਦਾ ਕੋਨਟੇਂਟ ਬਣਾ ਕੇ ਔਨਲਾਈਨ ਪਾ ਸਕਦੇ ਹਾਂ ਜਿਸ ਕਰਕੇ ਜਿਹੜੇ ਬੱਚੇ ਜਿਮ ਜਾਂ ਹੋਰ ਇੱਦਾਂ ਦੀਆ ਤਕਨੀਕਾਂ ਨਹੀਂ ਪੂਰੀ ਕਰ ਸਕਦੇ ਉਹ ਪੂਰੀ ਕਰ ਸਕਦੇ ਹਨ